ਮੇਰਾ ਸ਼ੌਕ ਪੂਰਾ ਕਰਨ ਲਈ ਮੇਰਾ ਸਾਰਾ ਪਰਿਵਾਰ ਮੇਰਾ ਮਤਲਬ ਪੂਰਾ ਸਾਥ ਦਿੰਦੇ ਨੇ ਜਿਹੜੇ ਫੋਟੋਗ੍ਰਾਫੀ ਜਿਹੜੀ ਹੈਗੀ ਹੈ ਇੱਕ ਇਹੋ ਜਿਹੀ ਚੀਜ਼ ਹੈ ਕਿ ਅਸੀਂ ਜਿੱਥੇ ਮਰਜ਼ੀ ਖਿੱਚ ਕੇ ਆਪਣੇ ਮੋਬਾਈਲ 'ਤੇ ਸੇਵ ਕਰਕੇ ਰੱਖ ਸਕਦੇ ਹਾਂ ਕੱਲ੍ਹ ਨੂੰ ਜਦੋਂ ਕਿਸੇ ਬੱਚਾ ਵੀ ਜਦੋਂ ਛੋਟਾ ਹੁੰਦਾ ਬੱਚੇ ਦੀ ਵੀ ਇੱਕ ਮੈਮਰੀਜ਼ ਜਿਹੜੀਆਂ ਅਸੀਂ ਜਿਹੜੀਆਂ ਖਿੱਚਦੇ ਹਾਂ ਕੱਲ੍ਹ ਨੂੰ ਜਦੋਂ ਬੱਚਾ ਵੱਡਾ ਹੁੰਦਾ ਹੈ ਤਾਂ ਉਹ ਆਪਣੀ ਮੈਮਰੀਜ਼ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਸਾਡੇ ਘਰ ਇਹ ਚੀਜ਼ ਨੂੰ ਬਹੁਤ ਜ਼ਿਆਦਾ ਮਤਲਬ ਬੜਾਵਾ ਦਿੱਤਾ ਜਾਂਦਾ ਹੈ ਕਿ ਮਤਲਬ ਇਹ ਚੀਜ਼ ਜਿੰਨੀ ਹੋ ਸਕੇ ਖਿੱਚੋ ਪ੍ਰਭਾਵਿਤ ਕਰਦਾ ਕਿ ਮੇਰਾ ਪਰਿਵਾਰ ਮੇਰਾ ਬਹੁਤ ਜ਼ਿਆਦਾ ਸਾਥ ਦਿੰਦਾ ਹੈ ਕਿਉਂਕਿ ਜਿਹੜੀਆਂ ਮੈਮਰੀਜ਼ ਹੁੰਦੀਆਂ ਨੇ ਆਹ ਮੋਬਾਇਲ 'ਚ ਵਿੱਚ ਸੇਵ ਕਰਕੇ ਰੱਖੀਆਂ ਜਾਂਦੀਆਂ ਨੇ ਕੱਲ੍ਹ ਨੂੰ ਜਦੋਂ ਬੱਚਾ ਵੀ ਛੋਟੇ ਤੋਂ ਵੱਡਾ ਹੁੰਦਾ ਹੈ ਜਾਂ ਕੋਈ ਹੋਰ ਆਪਾਂ ਕਿਤੇ ਜਾਂਦੇ ਹਾਂ ਸਾਨੂੰ ਇਹ ਚੀਜ਼ਾਂ ਫਿਰ ਦੁਬਾਰਾ ਜਦੋਂ ਵੇਖਣ ਨੂੰ ਮੈਮਰੀਸ ਮਿਲਦੀਆਂ ਨੇ ਅਸੀਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ ਜਿਹਦੇ ਕਰਕੇ ਜਿਹੜਾ ਸ਼ੌਕ ਹੈ ਮੇਰਾ ਸਾਰਾ ਪਰਿਵਾਰ ਮੇਰਾ ਇਸ ਚੀਜ਼ ਨਾਲ ਸਾਥ ਦਿੰਦਾ ਹੈ ਉਹ ਸਗੋਂ ਖੁਦ ਇਹ ਚੀਜ਼ ਨੂੰ ਆਪ ਵੀ ਇੰਜੋਏ ਇੰਜੋਏ ਕਰਦੇ ਨੇ ਫੋਟੋਗ੍ਰਾਫੀ ਨੂੰ